ਜ਼ਿਆਦਾਤਰ ਲੋਕ ਸ਼ਹਿਰਾਂ ਵਿੱਚ ਰਹਿਣਾ ਪਸੰਦ ਕਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਹਿਰਾਂ ਦੇ ਵਿੱਚ ਜ਼ਿਆਦਾ ਸਹੂਲਤਾਂ ਹਨ ਉੱਥੇ ਰਹਿਣ ਦੇ ਵਾਸਤੇ ਉਨ੍ਹਾਂ ਨੂੰ ਇਸ ਤਰ੍ਹਾਂ ਲੱਗਦਾ ਲੋਕਾਂ ਨੂੰ ਕਿ ਇ ਸ਼ਹਿਰ ਦੇ ਵਿੱਚ ਸਾਨੂੰ ਅਸੀਂ ਜ਼ਿਆਦਾ ਜਿਹੜਾ ਹੈ ਵਧੀਆ ਆਪਣੀ ਜ਼ਿੰਦਗੀ ਗੁਜ਼ਾਰ ਸਕਦੇ ਹਾਂ ਇਸੇ ਕਰਕੇ ਲੋਕੀ ਪਿੰਡਾਂ ਤੋਂ ਜ਼ਿਆਦਾ ਸ਼ਹਿਰਾਂ ਦੇ ਵੱਲ ਆਉਣਾ ਪਸੰਦ ਕਰਦੇ ਹਨ